ਮਨਪਸੰਦ ਦੌੜ ਮੇਰੀ ਸੌ ਮੀਟਰ ਹੰਡਰਡ ਮੀਟਰ ਦੀ ਹੈ ਅਤੇ ਇੱਕ ਵਾਰ ਚਾਰ ਸੌ ਮੀਟਰ ਦੀ ਦੌੜ ਦੇ ਵਿੱਚ ਹਿੱਸਾ ਲਿਆ ਸੀ ਸਪਰੈਂਟ ਹੀ ਸੀ ਉਸ ਨੂੰ ਦੋ ਸੌ ਮੀਟਰ ਤੱਕ ਪੂਰੀ ਜਾਨ ਨਾਲ ਭੱਜਿਆ ਪਰ ਦੋ ਸੌ ਮੀਟਰ ਤੋਂ ਬਾਅਦ ਜੀਭ ਹਲਕ ਨਾਲ ਲੱਗ ਗਈ ਜੀ ਕਰੇ ਖੜਾਂ ਮਗਰ ਡੀ ਪੀ ਡੰਡਾ ਲਈ ਖੜਾ ਸੀ ਖੜ੍ਹਨ ਵੀ ਨਹੀਂ ਦਿੰਦੇ ਸੀ ਚਾਰ ਸੌ ਮੀਟਰ ਦੀ ਦੌੜ ਪੂਰੀ ਕਰਨ ਉਪਰੰਤ ਗੋਡਿਆਂ ਭਾਰ ਥੱਲੇ ਡਿੱਗੇ ਉਹ ਤੋਂ ਬਾਅਦ ਡੰਡੇ ਖਾਧੇ ਉਹ ਯਾਦ ਕਦੇ ਵੀ ਨਹੀਂ ਭੁੱਲਦੀ ਬਾਕੀ ਦੌੜਾਂ ਤਾਂ ਕਈ ਲਗਾਈਆਂ ਹੋਰ ਵੀ ਪਰ ਜਿਹੜੀ ਉਹ ਚਾਰ ਸੌ ਮੀਟਰ ਵਾਲੀ ਦੌੜ ਸੀ ਉਹਨੇ ਨਾ ਬਹੁਤ ਭੈੜੀ ਕੀਤੀ ਉਸ ਤੋਂ ਬਾਅਦ ਪੰਜ ਹਜ਼ਾਰ ਮੀਟਰ ਦੀ ਇੱਕ ਦੌੜ ਲਗਾਈ ਸੀ ਉਹ ਉਹ ਵੀ ਬਹੁਤ ਔਖੀ ਦੌੜ ਸੀ ਪਰ ਪੰਜਾਬੀ ਯੂਨੀਵਰਸਟੀ ਪਈ ਸੀ ਉਹ ਬਹੁਤ ਮਜ਼ੇਦਾਰ ਸੀ ਉਸ ਨੂੰ ਦੌੜਨ ਦੇ ਵਿੱਚ ਬਹੁਤ ਮਜ਼ਾ ਆਇਆ ਪੰਜਾਬੀ ਯੂਨੀਵਰਸਟੀ ਦੀ ਅਥਲੈਟਿਕਸ ਮੀਟ 'ਤੇ ਉਹ ਦੌੜ ਦੌੜੀ ਸੀ ਪੰਜ ਹਜ਼ਾਰ ਮੀਟਰ ਦੀ ਜੋ ਅੱਜ ਵੀ ਯਾਦ ਹੈ ਹੋਰ ਵੀ ਕਈ ਦੌੜਾਂ ਦੇ